ਹਾਂਜੀ ਅਸੀਂ ਵੀ ਆਪਣੇ ਘਰ ਵਿੱਚ ਬਹੁਤ ਤਰ੍ਹਾਂ ਦੀਆਂ ਪੌਦੇ ਲਾਏ ਦੇ ਜੀ ਜਿਹਦੇ ਵਿੱਚੋਂ ਗੁੱਟਾ ਲਾਲ ਫੁੱਲ ਵਾਈਟ ਫੁੱਲ ਗੁਲਾਬੀ ਫੁੱਲ ਦੇ ਵੀ ਕਲਮਾਂ ਲਾਈ ਦੀਆਂ ਜੀ ਤੁਲਸੀ ਲਾਈ ਦੀ ਹੈ ਜੀ ਜਿਹਦੇ ਵਿੱਚੋਂ ਸਦਾਬਹਾਰ ਫੁੱਲ ਲੱਗ ਦੇ ਜੀ ਹੋਰ ਵੀ ਬੜੀਆਂ ਤਰ੍ਹਾਂ ਦੀਆਂ ਨਸਲਾਂ ਦੇ ਫੁੱਲ ਲਾਏ ਦੇ ਹੈ ਜੀ ਅਤੇ ਜਿਹਦੇ ਵਿੱਚੋਂ ਰੰਗ ਬਰੰਗੇ ਫੁੱਲ ਸਵੇਰੇ ਦੇਖਣ ਨੂੰ ਮਿਲਦੇ ਔਰ ਵਧੀਆ ਵੀ ਲੱਗਦੀ ਹੈ ਹੋਰ ਵੀ ਜਿਹੜੀ ਹੈ ਇਹ ਤੋਂ ਵੱਧ ਕੇ ਚੀਜ਼ਾਂ ਉਹ ਐਲੋ ਵੀਰਾ ਵੀ ਲਾਏ ਦਾ ਜੀ ਜਿਹਦੇ ਵਿੱਚੋਂ ਹੋਰ ਵੀ ਜਿਹਦੇ ਨਾ ਲਾਏ ਦੇ ਹੈ ਬਹੁਤ ਸਹੀ ਫੁੱਲ ਲਾਏ ਦੇ ਹੈ